ਹਾਂਜੀ ਕੁਝ ਲੋਕ ਰਾਜਨੀਤਿਕ ਤਨਾਅ ਪੈਦਾ ਕਰਨ ਲਈ ਧਰਮ ਦਾ ਫ਼ਾਇਦਾ ਉਠਾ ਰਹੇ ਹਨ ਰਾਜਨੀਤਿਕ ਲੋਕ ਆਪਣੇ ਫ਼ਾਇਦੇ ਲਈ ਆਪਸ ਵਿੱਚ ਧਰਮ ਆਪਣੇ ਧਰਮ ਲਈ ਲੋਕਾਂ ਨੂੰ ਇੱਕ ਦੂਜੇ ਦੇ ਹੋਣ ਨਹੀਂ ਦਿੰਦੇ ਅਤੇ ਆਪਸ ਵਿੱਚ ਧਰਮ ਦੇ ਨਾਂ ਤੇ ਫ਼ਾਇਦੇ ਉਠਾਉਂਦੇ ਹਨ ਅਤੇ ਲੜਾਉਂਦੇ ਹਨ ਜਿਸ ਤਰ੍ਹਾਂ ਕਿ ਧਰਮ ਨੂੰ ਵਪਾਰ ਵਜੋਂ ਇਸ ਤਰ੍ਹਾਂ ਵਰਤਿਆ ਜਾ ਰਿਹਾ ਕਿ ਗੁਰੂ ਸਾਹਿਬਾਨ ਨੇ ਕਿਹਾ ਸੀ ਕਿ ਜਿੰਨੀ ਕੁ ਤੁਹਾਡੇ ਘਰ ਦੀ ਰੋਟੀ ਪਾਣੀ 'ਚ ਆ ਸਕੇ ਤੁਸੀਂ ਉਨੀ ਮਰਿਆਦਾ ਅਨੁਸਾਰ ਵ ਭੇਟਾਂ ਰੱਖੋ ਲੇਕਿਨ ਅੱਜ ਕੱਲ੍ਹ ਉਹਨਾਂ ਨੇ ਭੇਟਾਂ ਨੂੰ ਆਪਣਾ ਵਪਾਰ ਬਣਾ ਲਿਆ ਹੈ ਸਾਨੂੰ ਇਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ